ਰਾਜ ਸਿਹਤ ਸੰਭਾਲ ਦੇ ਜਿਹੜੇ ਖਰਚੇ ਵੱਧ ਰਹੇ ਹਨ ਉਹਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਪੰਜਾਬ ਵਿੱਚ ਪੰਜਾਬ ਸਰਕਾਰ ਬਹੁਤ ਜ਼ਿਆਦਾ ਮਦਦ ਕਰ ਰਹੀ ਹੈ ਉਹ ਜਿਹੜੇ ਹੈਗੇ ਆਮ ਆਦਮੀ ਕਲੀਨਿਕ ਖੋਲ੍ਹੇ ਹੋਏ ਨੇ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜਿਹੜੇ ਸਾਡੇ ਟੈਸਟ ਹੈਗੇ ਹੈਗੇ ਉਹ ਵੀ ਘੱਟ ਜਿਹੜੇ ਹੈਗੇ ਹੈਗੇ ਕੀਮਤ 'ਤੇ ਸਾਨੂੰ ਪੈਣੇ ਪੈਂਦੇ ਹੈ ਅਤੇ ਜਿਹੜੀਆਂ ਦਵਾਈਆਂ ਨੇ ਉਹ ਸਰਕਾਰ ਵੱਲੋਂ ਜਮਾਂ ਫਰੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਜਿਹੜੇ ਹੈਗੇ ਆ ਗਰੀਬ ਪਰਿਵਾਰ ਜਾਂ ਆਮ ਆਦਮੀ ਹੈਗੇ ਆ ਜਿਹੜੇ ਉਹਨਾਂ ਨੂੰ ਕੁਛ ਵੀ ਦਿੱਕਤ ਨਾ ਆਵੇ ਜਿਵੇਂ ਹੁਣ ਕਿ ਕੋਈ ਹੈਲਥ ਵਾਸਤੇ ਆਪਾਂ ਨੂੰ ਸਿਹਤ ਵਾਸਤੇ ਆਹ ਟੈਸਟ ਕਰਵਾਉਣੇ ਹੁੰਦੇ ਹਨ ਪ੍ਰਾਈਵੇਟ ਕਲੀਨਕਾਂ ਦੇ ਵਿੱਚ ਐਨੇ ਐਨੇ ਪੈਸੇ ਜਿਹੜੇ ਹੈਗੇ ਲਏ ਜਾਂਦੇ ਹਨ ਪਰ ਇੱਥੇ ਆਮ ਆਦਮੀ ਕਲੀਨਿਕ ਦੇ ਵਿੱਚ ਕੋਈ ਵੀ ਖਰਚਾ ਨਹੀਂ ਹੈਗਾ ਗਾ ਅਤੇ ਪੇਸ਼ੈਂਟ ਨੂੰ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਉਹਦਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਫਿਰ ਉਹਦੇ ਜਿਹੜੇ ਹੈਗੇ ਆ ਬਿਨਾ ਖਰਚੇ ਤੋਂ ਉਹਨੂੰ ਦਵਾਈਆਂ ਜਿਹੜੇ ਜਿਹੜੇ ਰੂਟੀਨ ਦੇ ਬਜ਼ੁਰਗ ਨੇ ਅਤੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਦਵਾਈਆਂ ਦੀ ਜ਼ਰੂਰਤ ਹੁੰਦੀ ਹੈਗੀ ਹੈ ਬਜ਼ੁਰਗਾਂ ਦੀ ਸਿਹਤ ਸੰਭਾਲ ਦੇ ਲਈ ਉਹਨਾਂ ਨੂੰ ਨੂੰ ਜਿਵੇਂ ਆਮ ਆਪਣੀਆਂ ਬਿਮਾਰੀਆਂ ਹੁਣ ਵੱਧਦੀਆਂ ਜਾ ਰਹੀਆਂ ਨੇ ਬੀ ਪੀ ਸ਼ੂਗਰ ਇਹਨਾਂ ਬਿਮਾਰੀਆਂ ਦਾ ਇਲਾਜ ਲਈ ਉਹਨਾਂ ਨੂੰ ਪ੍ਰੋਪਰ ਦਵਾਈ ਬਿਨਾ ਕੋਈ ਪੈਸੇ ਦਿੱਤੇ ਜਾਂ ਬਿਨਾ ਕੋਈ ਖਰਚੇ ਤੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਇਹਦੇ ਨਾਲ ਇੱਕ ਤਾਂ ਉਹਨਾਂ ਦਾ ਜਿਹੜਾ ਹੈਗਾ ਦਿਮਾਗ ਉੱਪਰ ਦਵਾਈਆਂ ਦੀ ਲੈਣ ਦੀ ਜਾਂ ਉਹਦੇ ਖਰਚੇ ਦੀ ਟੈਂਸ਼ਨ ਹੈਗੀ ਹੈ ਉਹ ਘੱਟ ਜਾਂਦੀ ਹੈ ਅਤੇ ਦੂ ਦੂਸਰਾ ਜਿਹੜਾ ਹੈਗਾ ਉਹਨਾਂ ਦੇ ਉਹਨਾਂ ਨੂੰ ਇਸ ਚੀਜ਼ ਦੀ ਰਹਿੰਦੀ ਹੈਗੀ ਕਿ ਹਾਂ ਚਲੋ ਸਾਨੂੰ ਸਾਡੀ ਕੋਈ ਧਿਆਨ ਕਰਨ ਵਾਲਾ ਹੈਗਾ ਸਾਨੂੰ ਬਿਨਾ ਖਰਚੇ ਤੋਂ ਦਵਾਈ ਮਿਲ ਰਹੀ ਹੈ ਅਸੀਂ ਜਿਹੜੇ ਬਜ਼ੁਰਗ ਹਨ ਉਹ ਦੇਸ਼ ਦੀ ਪੂੰਜੀ ਹੁੰਦੇ ਹਨ ਉਹਨਾਂ ਨੂੰ ਸੰਭਾਲਿਆ ਜਾ ਸਕਦਾ ਹੈ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ ਹੈ ਉਹਨਾਂ ਨੂੰ ਨੂੰ ਸਮੇਂ ਸਿਰ ਦਵਾਈ ਮਿਲਦੀ ਹੈ ਅਤੇ ਇਹਦੇ ਵਿੱਚੋਂ ਉਹਨਾਂ ਨੂੰ ਵਧੀਆ ਰਹਿੰਦਾ ਹੈ ਉਹਨਾਂ ਦਾ ਸਰੀਰ ਅਤੇ ਉਹਨਾਂ ਦਾ ਦਿਮਾਗ ਸੰਤੁਲਨ ਸਾਰਾ ਕੁਛ ਇਹਦੇ ਨਾਲ ਸਹੀ ਰਹਿੰਦਾ ਹੈ